ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹਨ ਇਸ ਦੇਸ਼ ਦੇ ਵਿੱਚ ਵੱਖ ਵੱਖ ਧਰਮ ਹੈ ਹਨ ਜਿਵੇਂ ਕਿ ਪੰਜਾਬੀ ਪੰਜਾਬ ਹਿੰਦੂ ਸਿੱਖ ਇਸਾਈ ਮੁਸਲਮਾਨ ਸਾਰੇ ਧਰਮ ਇਸ ਦੇਸ਼ ਦੇ ਵਿੱਚ ਰਹਿੰਦੇ ਹਨ ਇੱਥੇ ਬਹੁਤ ਜ਼ਿਆਦਾ ਧਰਮ ਹੋਣ ਦੇ ਕਰਕੇ ਬਹੁਤ ਜ਼ਿਆਦਾ ਆਬਾਦੀ ਹੈ ਮਗਰ ਇੱਥੇ ਸਾਰੇ ਇੱਕ ਜੁੱਟ ਹੋ ਕੇ ਰਹਿੰਦੇ ਹਨ ਸਾਰੇ ਧਰਮ ਇਕੁਅਲੀ ਇਮਪੋਰਟੈਂਟ ਹਨ ਕਿਉਂਕਿ ਸਾਰੇ ਰੱਬ ਇੱਕ ਹੈ ਕਿਉਂਕਿ ਰੱਬ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ ਅਤੇ ਧਰਮ ਇੱਥੇ ਲੋਕਾਂ ਨੇ ਆਪਸ ਵਿੱਚ ਬਣਾਏ ਹਨ ਇਸ ਕਰਕੇ ਆਪਾਂ ਨੂੰ ਰੱਬ ਦੀ ਮੰਨਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਇਕੁਅਲੀ ਇਮਪੋਰਟੈਂਸ ਦੇਣੀ ਚਾਹੀਦੀ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਇੱਥੇ ਸਾਨੂੰ ਪਿਆਰ ਅਤੇ ਸ਼ਾਂਤੀ ਨਾਲ ਰਹਿਣਾ ਚਾਹੀਦਾ ਹੈ ਆਪਾਂ ਨੂੰ ਸਾਰੇ ਧਰਮ ਇਕੁਅਲ ਹੋਣ ਦੇ ਕਾਰਨ ਸਾਨੂੰ ਕੋਈ ਨਫ਼ਰਤ ਨਹੀਂ ਕਰਨੀ ਚਾਹੀਦੀ ਸਾਰਿਆਂ ਦੇ ਭੂਮਿਕਾ ਇੱਥੇ ਬਹੁਤ ਜ਼ਿਆਦਾ ਮਤਲਬ ਧਰਮ ਦੇ ਰਿਲੇਟਿਡ ਬਹੁ ਇੱਕ ਇੱਕ ਅਹਿਮੀਅਤ ਨਿਭਾਉਣੀ ਚਾਹੀਦੀ ਹੈ ਆਪਾਂ ਨੂੰ ਸਾਰਿਆਂ ਦੇ ਰੱਬ ਨੂੰ ਮੰਨਣਾ ਚਾਹੀਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ